ਬਾਗ ਦੀ ਗੱਲ ਕਰੀਏ ਤਾਂ ਬਾਗ ਦਾ ਜਿਹੜਾ ਮੁੱਖ ਮੰਤਵ ਹੈ ਉਹ ਹੈ ਫਲ ਲੈਣਾ ਅਤੇ ਉਹ ਫਲਾਂ ਨੂੰ ਵੇਚਣਾ ਜਿਸ ਨਾਲ ਕਮਾਈ 'ਚ ਵਾਧਾ ਹੋ ਸਕੇ ਇਹ ਇੱਕ ਆਮਦਨ ਦਾ ਸਰੋਤ ਹੈ ਇਹ ਸਰੋਤ ਦੇ ਨਾਲ ਬਹੁਤ ਸਾਰੇ ਜਿਹੜੇ ਆਪਾਂ ਨੂੰ ਫਾਇਦੇ ਵੀ ਮਿਲਦੇ ਕਿਉਂਕਿ ਜਦੋਂ ਬਾਗ ਹੁੰਦਾ ਤਾਂ ਬਾਗ ਦੇ ਜਿਹੜੇ ਫਲ ਅਤੇ ਫੁੱਲ ਉਹ ਅਸੀਂ ਆਮ ਵਰਤਦੇ ਹਾਂ ਆਮ ਖਾਂਦੇ ਹਾਂ ਅਤੇ ਆਪਣੇ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਵੀ ਦਿੰਦੇ ਹਾਂ ਜੇਕਰ ਆਪਾਂ ਗੱਲ ਕਰੀਏ ਕਿ ਫਲਾਂ ਦੀ ਤਾਂ ਹਰ ਇਨਸਾਨ ਹਰ ਰੋਜ਼ ਫਲ ਲਿਆ ਕੇ ਨਹੀਂ ਖਾ ਸਕਦਾ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ ਅਤੇ ਸੋਚ ਵਿਚਾਰ ਕੇ ਉਹ ਖਰਚਾ ਕਰਦਾ ਪਰ ਜੇਕਰ ਆਪਣੇ ਬਾਗ ਹੁੰਦਾ ਜਾਂ ਘਰ ਕਹਿ ਲਓ ਪੰਜ ਚਾਰ ਬੂਟੇ ਲਾਏ ਹੈ ਤਾਂ ਉਹਨਾਂ 'ਤੇ ਜਦੋਂ ਫਲ ਦਾ ਸੀਜ਼ਨ ਆਉਂਦਾ ਤਾਂ ਉਸ ਨਾਲ ਉਹਨਾਂ ਦੇ ਘਰ ਫਲ ਵਾਧੂ ਰਹਿੰਦੇ ਹੈ ਜਿਸ ਦੇ ਨਾਲ ਉਹ ਆਪ ਵੀ ਖਾਂਦੇ ਹੈ ਨਾਲ ਦੀ ਨਾਲ ਆਪਣੇ ਰਿਸ਼ਤੇਦਾਰ ਸਕੇ ਸੰਬੰਧੀਆਂ ਜਾਂ ਆਂਢੀਆਂ ਗਵਾਂਢੀਆਂ ਨੂੰ ਵੀ ਉਹ ਮਿਲਦੇ ਹੈ ਉਹਨਾਂ ਨੂੰ ਦਿੱਤੇ ਜਾਂਦੇ ਹੈ